ਅਠਾਰਾਂ ਮਈ ਉੱਨੀ ਸੌ ਤਿਹੱਤਰ ਇਕੱਤੀ ਮਈ ਦੋ ਹਜ਼ਾਰ ਅੱਠ ਚਾਰ ਦਸੰਬਰ ਦੋ ਹਜ਼ਾਰ ਤਿੰਨ ਅਠਾਰਾਂ ਨਵੰਬਰ ਉੱਨੀ ਸੌ ਤਿਹੱਤਰ ਸਤਾਈ ਫ਼ਰਵਰੀ ਉੱਨੀ ਸੌ ਅੱਸੀ